ਪੰਜਾਬੀ ਦੇ ਭੰਗੜਾ ਸੰਗੀਤਕ ਕਈ ਤਰ੍ਹਾਂ ਦੇ ਸਾਜ਼ ਹਨ ਜਿਵੇਂ ਕਿ ਢੋਲ ਹੋ ਗਿਆ ਢੱਡ ਸਰੰਗੀ ਹੋ ਗਈ ਗਿੜਦਾ ਹੋ ਗਿਆ ਅਲਗੋਜ਼ੇ ਹੋ ਗਏ ਕਾਟੋ ਹੋ ਗਏ ਚਿਮਟੇ ਹੋ ਗਏ ਇਹ ਪੁਰਾਣੇ ਸਮਿਆਂ ਦੇ ਵਿੱਚ ਤਾਂ ਇੱਕ ਭੰਗੜੇ ਦੀ ਸ਼ਾਨ ਹੁੰਦੀ ਸੀ ਬਈ ਤੁਸੀਂ ਕਹਿ ਲਓ ਵੀ ਭੰਗੜਾ ਇਹਨਾਂ ਸਾਜ਼ਾਂ ਦੇ ਬਿਨਾਂ ਅਧੂਰਾ ਹੀ ਸੀਗਾ ਉਦੋਂ ਜਦੋਂ ਕਿਤੇ ਵਿਆਹ ਸ਼ਾਦੀਆਂ 'ਚ ਜਾਂ ਮੇਲਿਆਂ 'ਚ ਲੋਕ ਭੰਗੜਾ ਪਾਉਂਦੇ ਸੀ ਅਤੇ ਇਹਨਾਂ ਸਾਜ਼ਾਂ ਵਾਲੀ ਫਿਰ ਮਹਿਫਲ ਬੱਝਦੀ ਸੀ ਉਦੋਂ ਜਦੋਂ ਢੋਲ ਦੇ ਡਗੇ 'ਤੇ ਬੰਦਿਆਂ ਦੇ ਨਾਲ ਨਾਲ ਘੋੜੀਆਂ ਵੀ ਨੱਚਦੀਆਂ ਸੀ ਪੁਰਾਣਿਆਂ ਸਮਿਆਂ 'ਚ ਤਾਂ ਤੂੰਬੀ ਤੂੰਬੀ ਵੀ ਇੱਕ ਆਪਣਾ ਰਵਾਇਤੀ ਸ ਸੰਗੀਤਿਕ ਸਾਜ਼ ਹੀ ਹੈ

ਇਹ ਪੁਰਾਣੀ ਜਿਹੜੀ ਸਾਜ਼ ਆ ਨਾ ਇਹ ਭੰਗੜੇ ਦੇ ਲਈ ਹੀ ਬਣੇ ਸੀ ਉਦੋਂ ਇਹਨਾਂ ਸਾਜ਼ਾਂ ਨਾਲ ਹੀ ਲੋਕ ਮਹਿਫਿਲਾਂ ਬੰਨ੍ਹਦੇ ਸੀ ਉਦੋਂ ਪੁਰਾਣੇ ਸਮਿਆਂ 'ਚ ਧੰਨਵਾਦ